ਤੁਸੀਂ ਭਾਰਤ ਬੁੱਕ ਡਿਪੂ ਤੋਂ ਬੋਲ ਰਹੇ ਹੋ ਜੀ ਮੈਂ ਮੈਡਮ ਐਕਚੁਆਲੀ ਨਾ ਟੈਨਥ ਪਾਸ ਕੀਤੀ ਆ ਹੁਣੇ ਅਤੇ ਮੈਂ ਆਪਣੀ ਟੈਨਥ ਦੀਆਂ ਬੁੱਕਸ ਜਿਹੜੀਆਂ ਦੇਣੀਆ ਸੀਗੀਆ ਔਰ ਮੈਂ ਪਲੱਸ ਵੰਨ ਦੇ ਵਿਚ ਕਮਰਸ ਰੱਖਣਾ ਚਾਹੁੰਦੀ ਹਾਂ ਤਾਂ ਫਿਰ ਮੈਂ ਕਮਰਸ ਦੀਆਂ ਬੁੱਕਸ ਮੈਨੂੰ ਚਾਹੀਦੀਆਂ ਹੋਣਗੀਆ ਹਾਂਜੀ ਮੈਡਮ ਜਿਹੜੇ ਪਲੱਸ ਵਨ ਦੇ ਵਿਚ ਕਮਰਸ ਦੇ ਸਬਜੈਕਟ ਹੁੰਦੇ ਇੱਕ ਤਾਂ ਅਕਾਊਂਟਸ ਹੁੰਦਾ ਮੈਡਮ ਇੱਕ ਹੁੰਦਾ ਬਿਜਨਸ ਸਟਡੀਜ਼ ਹੁੰਦਾ ਇਕ ਔਫਿਸ ਹੁੰਦਾ ਔਰ ਇੱਕ ਸ਼ਾਇਦ ਇਕਨੋਮਿਕਸ ਹੁੰਦੀ ਆ ਅੱਛਾ ਜੀ ਤੁਹਾਡੇ ਕੋਲ ਸਾਰੀਆਂ ਹੈਗੀਆਂ ਨਵੇਂ ਆਡੀਸ਼ਨ ਦੀਆਂ ਬੁੱਕਸ ਹੈਗੀਆ ਮੈਡਮ ਪੁਰਾਣੇ ਸਾਲਾਂ ਦੀਆਂ ਤਾਂ ਨਹੀਂ ਹੈਗੀਆਂ ਠੀਕ ਹੈ ਜੀ ਔਰ ਔਰ ਜਿਹੜੀਆਂ ਪੁਰਾਣੀਆ ਸੀਗੀਆ ਟੈਨਥ ਵਾਲੀਆਂ ਬੁੱਕਸ ਉਹ ਤੁਸੀਂ ਕਿਨੇ ਵਿੱਚ ਵਾਪਿਸ ਲਓਂਗੇ ਅੱਛਾ ਜੀ ਵੈਸੇ ਮੇਰੀਆ ਬੁੱਕਸ ਤਾਂ ਮੈਮ